ਇੱਕ ਬਾਰਾਂ ਉੱਨੀ ਸੌ ਛਿਆਨਵੇਂ ਵੀਹ ਬਾਰਾਂ ਉੱਨੀ ਸੌ ਅਠਾਨਵੇਂ ਪੰਦਰਾਂ ਦਸ ਦੋ ਹਜ਼ਾਰ ਤੇਈ ਦੋ ਮਾਰਚ ਦੋ ਹਜ਼ਾਰ ਚੌਵੀ ਅਤੇ ਸੋਲ੍ਹਾਂ ਅਪ੍ਰੈਲ ਦੋ ਹਜ਼ਾਰ ਪੰਜ